ਹੈਲੋ ਹਾਂਜੀ ਸਰ ਤੁਸੀਂ ਪੇਂਟ ਕੰਪਨੀ ਤੋਂ ਬੋਲ ਰਹੇ ਹੋ ਹਾਂਜੀ ਸਰ ਅਸੀਂ ਆਪਦੇ ਘਰ ਦੇ ਅੰਦਰ ਕ ਕਲਰ ਕਰਵਾਉਣਾ ਸੀ ਪੂਰੇ ਘਰ ਦੇ ਅੰਦਰ ਬੈੱਡਰੂਮ ਡਰੋਇੰਗ ਰੂਮ ਲੋਬੀ ਕਿਚਨ ਸਭ ਦੇ ਅੰਦਰ ਕਰਵਾਉਣਾ ਸੀ ਤੁਸੀਂ ਦੱਸ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਕਰਦੇ ਹੋ ਕਲਰ ਵਗੈਰਾ ਪ੍ਰੋਵਾਈਡ ਹਾਂਜੀ

ਮੈਂ ਸਰ ਸੋਚ ਰਿਹਾ ਸੀ ਜਿਵੇਂ ਆਪਣੇ ਨੋਰਮਲ ਇੱਕ ਤਾਂ ਰੈੱਡ ਕਲਰ ਦਾ ਕਰਵਾ ਦੇਵਾਂਗੇ ਬੈੱਡਰੂਮ ਦੇ ਅੰਦਰ ਹਾਂਜੀ ਉਵੇਂ ਇੱਕ ਜੈਲੋ ਗੋਲਡਨ ਜਿਵੇਂ ਹੁੰਦਾ ਨਾ ਮਿਕਸ ਕਲਰ ਉਵੇਂ ਕਰਵਾਉਣਾ ਮੈਂ ਆਪਦੇ ਬੈ ਡਰਾਇੰਗ ਰੂਮ ਦੇ ਅੰਦਰ ਅਤੇ ਮੈਂ ਸੋਚ ਰਿਹਾ ਸੀ ਇੱਕ ਸ਼ੀਟਸ ਦਾ ਵੀ ਆਇਆ ਮੈਂ ਸੁਣਿਆ ਸ਼ੀਟਸ ਲੱਗ ਜਾਂਦੀਆਂ ਨੇ ਵੋਲਸ 'ਤੇ ਉਹ ਸਰ ਤੁਸੀਂ ਕਰਦੇ ਪ੍ਰੋਵਾਈਡ ਹਾਂਜੀ

ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ

ਮੈਂ ਸਰ ਸੋਚ ਰਿਹਾ ਪਹਿਲੇ ਅਸੀਂ ਪੱਟੀ ਮਰਾ ਲਈਏ ਫੇਰ ਉਹਦੇ ਉੱਤੇ ਕਲਰ ਜਿਹੜਾ ਹੁੰਦਾ ਉਹ ਕਰ ਲਈਏ ਹਾਂਜੀ ਹਾਂਜੀ ਸਰ ਤੁਸੀਂ ਕਿਹੜੀ ਕੰਪਨੀ ਦੇ ਕਲਰ ਲਾਉਂਦੇ ਹੋ ਵੀ ਦੱਸ ਸਕਦੇ ਹੋ ਏਸ਼ੀਅਨ ਪੇਂਟਸ ਠੀਕ ਹੈ ਹੂੰ

ਠੀਕ ਹੈ ਸਰ ਅੱਗੇ ਮੈਂ ਕਰਵਾਇਆ ਸੀ ਸੀਲਨ ਆ ਗਈ ਸੀ ਇਸ ਲਈ ਮੈਂ ਤੁਹਾਡੇ ਪੁੱਛ ਰਿਹਾ ਸੀ ਵਧੀਆ ਕੁਆਲਟੀ ਦਾ ਹੈ ਤੁਹਾਡੇ ਕੋਲ ਬਿਲਕੁਲ ਠੀਕ ਹੈ ਸਰ ਬਾਕੀ ਤੁਹਾਡੇ ਕੋਲ ਕੋਈ ਰੇਕੋਮੈਂਡੇਸ਼ਨ ਹੋਣ ਕਿ ਅਸੀਂ ਇਹ ਵਾਲਾ ਕਲਰ ਚੱਲ ਰਿਹਾ ਰੂਮ ਦੇ ਅੰਦਰ ਇਸ ਟਾਈਪ ਦੇ ਮਿਕਸਚਰ ਹਾਂਜੀ ਹਾਂਜੀ

ਠੀਕ ਹੈ ਸਰ ਵੈਸੇ ਮੈਂ ਤਾਂ ਸੋਚ ਰਿਹਾ ਸੀ ਵਾਈਟ ਹੁਣ ਤੁਸੀਂ ਵਾਈਟ ਰੇਕੋਮੈਂਡ ਕੀਤਾ ਤਾਂ ਮੈਂ ਆਪਦੇ ਬੈੱਡਰੂਮ ਦੇ ਅੰਦਰ ਵਾਈਟ ਕਰਾ ਲਵਾਂਗਾ ਤਾਂ ਅਤੇ ਡਰਾਇੰਗਸ ਰੂਮ ਵਗੈਰਾ ਅੰਦਰ ਕੋਈ ਲਾਈਟ ਕਲਰ ਕਰਵਾ ਲਵਾਂਗਾ ਜਿਵੇਂ ਪਿੰਕ ਹੈ ਜਾਂ ਫਿਰ ਜੈਲੋ ਕਲਰ ਜਿਹੜਾ ਜ਼ਿਆਦਾ ਮਤਲਬ ਹੋਵੇ ਨਾ ਲਾਈਟ ਸ਼ੇਡ ਜਾਂਦਾ ਅਤੇ ਇਹਦਾ ਖਰਚਾ ਵਗੈਰਾ ਦੱਸ ਦਿਉ ਕਿੰਨਾ ਆ ਸਕਦਾ ਅਗਰ ਪੂਰੇ ਘਰ ਦਾ ਕਰਵਾਈਏ ਠੀਕ ਹੈ ਠੀਕ ਹੈ ਹਾਂਜੀ ਠੀਕ ਠੀਕ ਹੈ ਸਰ ਠੀਕ ਠੀਕ ਹੈ ਸਰ ਤੁਸੀਂ ਮੈਨੂੰ ਡੇਟ ਦੱਸ ਦਿਉ ਤੁਸੀਂ ਆ ਜਿਉ ਜੇ ਠੀਕ ਹੈ ਸਰ ਥੈਂਕ ਊ